ਉੱਤਰੀ ਭਾਰਤ ਦੇ ਅਨੁਸਾਰ ਮੈਨੂੰ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਬਹੁਤ ਪਸੰਦ ਹੈ ਕਿਉਂਕਿ ਇਹ ਇਸ ਦਾ ਪਸੰਦ ਕਰਨ ਦਾ ਕਾਰਨ ਇਹ ਹੈ ਕਿਉਂਕਿ ਇਹ ਬਹੁਤ ਹੀ ਜੋ ਟਾਈਮ ਲਗਾ ਕੇ ਨੈਚੁਰਲ ਜਿਹੜੀ ਹਰੀ ਸਬਜ਼ੀ ਹੈ ਹਰਾ ਸਾਗ ਹੈ ਉਸਨੂੰ ਤੋੜ ਕੇ ਬਣਾਇਆ ਜਾਂਦਾ ਹੈ ਅਤੇ ਮਹਾਂਦੀਪੀ ਭੋਜਨ ਪਕਾਉਣ ਲਈ ਮੈਨੂੰ ਦੱਖਣੀ ਭਾਰਤ ਦੇ ਵਿੱਚ ਮੈਨੂੰ ਸਾਊਥ ਇੰਡੀਅਨ ਦੇ ਵਿੱਚ ਮੈਨੂੰ ਡੋਸਾ ਪਸੰਦ ਹੈ ਕਿਉਂਕਿ ਇਸਦਾ ਟੇਸਟ ਬਹੁਤ ਹੀ ਲਾਜਵਾਬ ਹੁੰਦਾ ਹੈ ਇਸ ਦੇ ਟੇਸਟ ਦੇ ਲਾਜਵਾਬ ਹੋਣ ਦੇ ਨਾਲ਼ ਨਾਲ਼ ਇਹ ਇੱਕ ਹੈਲਦੀ ਚੀਜ਼ ਵੀ ਹੈ ਜੋ ਕਿ ਸਾਨੂੰ ਫਾਸਟ ਫੂਡ ਜੰਕ ਫੂਡਾਂ ਤੋਂ ਵੀ ਦੂਰ ਰੱਖਦੀ ਹੈ ਜੰਕ ਫੂਡ ਦੇ ਮੁਤਾਬਿਕ ਡੋਸਾ ਹੋ ਗਿਆ ਸਰ੍ਹੋਂ ਦਾ ਸਾਗ ਹੋ ਗਿਆ ਇਹ ਬਹੁਤ ਵਧੀਆ ਮੰਨਿਆ ਜਾਂਦਾ ਹੈ